ਸਾਨੂੰ ਘਰ ਵਿੱਚ ਖਾਣਾ ਬਣਾਉਂਦੇ ਸਮੇਂ ਐੱਲ ਪੀ ਜੀ ਸਿਲੰਡਰ ਦੀ ਵਰਤੋਂ ਕਰਦੇ ਸਮੇਂ ਇਹ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਜਿਵੇਂ ਕਿ ਸਿਲੰਡਰ ਨੂੰ ਹਵਾ ਵਾਲੀ ਜਗ੍ਹਾ 'ਤੇ ਰੱਖਣਾ ਚਾਹੀਦਾ ਹਨ ਜਿੱਥੇ ਕਿ ਹਵਾ ਆਰ ਪਾਰ ਹੋ ਸਕੇ ਇਸ ਨੂੰ ਕਦੇ ਵੀ ਅੰਦਰ ਨਹੀਂ ਰੱਖਣਾ ਚਾਹੀਦਾ ਤਾਂ ਕਿ ਕਿਉਂਕਿ ਜਦੋਂ ਇਸ ਵਿ ਇਸ ਵਿੱਚ ਹਵਾ ਰੁੱਕ ਜਾਂਦੀ ਹੈ ਤਾਂ ਇਸ ਦੇ ਫੱਟਣ ਦਾ ਡਰ ਰਹਿੰਦਾ ਹੈ ਸਾਨੂੰ ਐੱਲ ਪੀ ਜੀ ਸਿਲੰਡਰ ਨੂੰ ਬੱਚਿਆਂ ਤੋਂ ਕਾਫ਼ੀ ਦੂਰ ਰੱਖਣਾ ਚਾਹੀਦਾ ਹੈ ਤਾਂ ਕਿ ਇਸਨੂੰ ਬੱਚੇ ਹੱਥ ਨਾ ਲਗਾਉਣ ਇਸ ਦੀ ਵਰਤੋਂ ਕਰਦੇ ਸਮੇਂ ਸਾਨੂੰ ਇਸ ਦਾ ਇਸ ਵਿੱਚ ਇਸ ਦੀ ਸੇਫਟੀ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ ਕਿ ਕਿਵੇਂ ਇਸ ਨੂੰ ਵਰਤਣਾ ਹੈ ਜਦੋਂ ਇਸ ਦੀ ਆਗ ਬਲਦੀ ਹੈ ਤਾਂ ਸਾਨੂੰ ਬੱਚਿਆਂ ਨੂੰ ਵੀ ਕਾਫ਼ੀ ਦੂਰ ਰੱਖਣਾ ਚਾਹੀਦਾ ਹੈ ਅਤੇ ਇਸ ਨੂੰ ਹਵਾ ਵਿੱਚ ਰੱਖਣਾ ਚਾਹੀਦਾ ਹੈ ਤਾਂ ਕਿ ਕੋਈ ਦੁਰਘਟਨਾ ਨਾ ਹੋ ਸਕੇ ਜਦੋਂ ਇਹ ਫੱਟਦਾ ਹੈ ਤਾਂ ਇਹ ਕਾਫ਼ੀ ਨੁਕਸਾਨ ਕਰ ਦਿੰਦਾ ਹੈ ਇਸ ਇਸ ਕਰਕੇ ਸਾਨੂੰ ਇਸ ਨੂੰ ਅੰਦਰ ਕਦੇ ਵੀ ਨਹੀਂ ਰੱਖਣਾ ਚਾਹੀਦਾ ਇਸ ਨੂੰ ਜ਼ਿਆਦਾਤਰ ਬਾਹਰ ਹੀ ਰੱਖਣਾ ਚਾਹੀਦਾ ਹੈ ਅਤੇ ਇਸ ਇਸ ਵਿੱਚ ਇਸ ਨੂੰ ਆਪਾਂ ਠੰਡੀ ਜਗ੍ਹਾ 'ਤੇ ਰੱਖੀਏ ਤਾਂ ਇਹ ਇਸ ਇਹ ਕਦੀ ਵੀ ਕਦੀ ਕਦੀ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਅਤੇ ਜ਼ਿਆਦਾਤਰ ਇਸਨੂੰ ਸੂਰਜ ਦੀ ਰੌਸ਼ਨੀ ਤੋਂ ਦੂਰ ਹੀ ਰੱਖਣਾ ਚਾਹੀਦਾ ਹੈ ਅਤੇ ਸਾਨੂੰ ਐਕਸਪੈਰੀ ਡੇਟ ਚੈੱਕ ਕਰਕੇ ਫਿਰ ਇਸਦੀ ਵਰਤੋਂ ਕਰਨੀ ਚਾਹੀਦੀ ਹੈ